ਮੈਂ ਹਰ ਰੋਜ਼ ਸ਼ਾਮ ਨੂੰ ਤਿੰਨ ਤੋਂ ਚਾਰ ਕਿਲੋਮੀਟਰ ਦੀ ਰਨਿੰਗ ਕਰਦਾ ਹਾਂ ਅਤੇ ਦੌੜਦੇ ਸਮੇਂ ਮੈਨੂੰ ਸੰਗੀਤ ਸੁਣਨ ਦੀ ਕਾਫੀ ਆਦਤ ਹੈ ਅਤੇ ਮੈਂ ਕਾਫੀ ਹੈ ਜੋ ਸਰੀਰ ਨੂੰ ਐਨਰਜੀ ਦੇਵੇ ਉਸ ਤਰ੍ਹਾਂ ਦੇ ਗਾਣੇ ਸੁਣਦਾ ਹਾਂ ਜਿਵੇਂ ਕਿ ਆਪਣੇ ਅਰਜਨ ਢਿੱਲੋਂ ਦੇ ਗੀਤ ਹੋ ਗਏ ਸਿੱਧੂ ਮੂਸੇਵਾਲਾ ਅਤੇ ਨਵਾਣ ਸੰਧੂ ਇਹਨਾਂ ਸੰਗੀਤਕਾਰਾਂ ਦੇ ਜੋ ਮੈਂ ਗੀਤ ਸੁਣਦਾ ਹਾਂ ਜਿਹਦੇ ਕਰਕੇ ਮੈਨੂੰ ਦੌੜਨ ਵਿੱਚ ਵੀ ਕਾਫੀ ਐਨਰਜੀ ਮਿਲਦੀ ਹੈ ਅਤੇ ਦੌੜਦੇ ਸਮੇਂ ਮੈਂ ਆਪਣੇ ਦਿਮਾਗ ਵਿੱਚ ਸੋਚਦਾ ਹਾਂ ਕਿ ਜਿੰਨਾਂ ਮੈਂ ਸੋਚਿਆ ਹੈ ਚਾ ਤਿੰਨ ਤੋਂ ਚਾਰ ਕਿਲੋਮੀਟਰ ਦੌੜਨ ਦਾ ਉਹ ਤੋਂ ਕੁਝ ਵੱਧ ਹੀ ਦੌੜਾਂ ਤਾਂ ਜੋ ਮੈਂ ਹਰ ਰੋਜ਼ ਕੁਝ ਨਾ ਕੁਝ ਜੋ ਆਪਣਾ ਟੀਚਾ ਹੈ ਉਹ ਤੋਂ ਕੁਝ ਵੱਧ ਕੇ ਕਰਾਂ ਜਦੋਂ ਮੈਂ ਦੌੜਦਾ ਹਾਂ ਮੇਰਾ ਧਿਆਨ ਕੇਂਦਰ ਹੁੰਦਾ ਹੈ ਆਪਣੇ ਟੀਚੇ ਦੇ ਉੱਤੇ ਦੌੜਨ ਕਰਕੇ ਹਰ ਰੋਜ਼ ਦੌੜ ਲਾਣ ਕਰਕੇ ਮੇਰੇ ਸਰੀਰ ਵਿੱਚ ਵੀ ਕਾਫੀ ਬਦਲਾਅ ਆਏ ਹਨ ਜਿਵੇ ਕਿ ਬਿਮਾਰੀਆਂ ਤੋਂ ਰਹਿਤ ਅਤੇ ਸਾਹ ਦੀ ਜੋ ਹੈ ਸਾਹ ਪੱਕ ਗਿਆ ਹੈ ਅਤੇ ਹੋਰ ਵੀ ਕਾਫੀ ਤਰ੍ਹਾਂ ਦੀਆਂ ਜੋ ਹੈ ਸਰੀਰ ਵਿੱਚ ਬਦਲਾਅ ਆ ਚੁੱਕੇ ਹਨ